ਦਸ ਨਵੰਬਰ ਉੱਨੀ ਸੌ ਛਿਆਸੀ ਉੱਨੀ ਜਨਵਰੀ ਉੱਨੀ ਸੌ ਚੁਰਾਨਵੇਂ ਵੀਹ ਮਈ ਦੋ ਹਜ਼ਾਰ ਵੀਹ ਅੱਠ ਜਨਵਰੀ ਦੋ ਹਜ਼ਾਰ ਉੱਨੀ ਸੌਲਾਂ ਦਸੰਬਰ ਦੋ ਹਜ਼ਾਰ ਤੇਈ